ਮੇਰਾ ਮਨਪਸੰਦ ਪੌਦਾ ਗੁਲਾਬ ਦਾ ਪੌਦਾ ਹੈ ਮੈਨੂੰ ਗੁਲਾਬ ਉਗਾਉਣਾ ਬਹੁਤ ਪਸੰਦ ਹੈ ਤਕਰੀਬਨ ਇੱਕ ਗੁਲਾਬ ਨੂੰ ਉਗਾਉਣ ਵਿੱਚ ਇੱਕ ਤੋਂ ਦੋ ਸਾਲ ਦਾ ਸਮਾਂ ਲੱਗਦਾ ਹੈ ਪਰ ਇਹ ਸਮੇਂ ਦੀ ਕੀਮਤ ਉਦੋਂ ਪੈਂਦੀ ਹੈ ਜਦੋਂ ਉਸ ਪੌਦੇ 'ਤੇ ਸੁੰਦਰ ਸੁੰਦਰ ਫੁੱਲ ਆਉਣ